ਪੰਜਾਬੀ ਭਾਸ਼ਾ ਵਿੱਚ ਕੁਝ ਆਮ ਵਾਕਾਂਸ਼ ਜਿਵੇਂ ਪਿਤਾ ਦਾ ਪਿਤਾ ਦਾਦਾ ਹੁੰਦਾ ਵਾ ਨਾਲੇ ਜਿੱਥੇ ਘੋੜੇ ਬੱਝਦੇ ਹਨ ਉਹਨੂੰ ਤਬੇਲਾ ਕਹਿੰਦੇ ਆ ਅਤੇ ਜਿਵੇਂ ਮਾਲਵੇ ਦੇ ਰਹਿਣ ਵਾਲਿਆਂ ਨੂੰ ਮਲਵਈ ਕਿਹਾ ਜਾਂਦਾ ਵਾ ਉਵੇਂ ਰੋਜ਼ਾਨਾ ਜ਼ਿੰਦਗੀ ਵਿੱਚ ਗੱਲਬਾਤ ਕਰਦੇ ਸਮੇਂ ਜਿਵੇਂ ਮੁਹਾਵਰੇ ਹਨ ਉਹ ਉਹ ਹਨ ਜਿਵੇਂ ਉਸਤਾਦੀ ਕਰਨਾ ਚਲਾਕੀ ਕਰਨਾ ਜਿਵੇਂ ਤੁ ਜੋ ਤੁਸੀਂ ਵੀ ਕਰੋਗੇ ਤੁਹਾਡੀ ਉਸਤਾਦੀ ਨਹੀਂ ਚੱਲਣੀ ਇੱਥੇ ਇਵੇਂ ਦੀਆਂ ਗੱਲਾਂ ਯੂਸ ਹੁੰਦੀਆਂ ਨੇ ਜਿਵੇਂ ਉਂਗਲੀ ਕਰਨਾ ਕਿਸੇ ਨੂੰ ਦੋਸ਼ ਲਾਉਣਾ ਜਿੱਦਾਂ ਆਪਾਂ ਬਿਨਾਂ ਸਬੂਤ ਤੋਂ ਕਿਸੇ ਵੱਲ ਉਂਗਲੀ ਕਰ ਦਿੰਦੇ ਹਾਂ ਵੀ ਇਹਨੇ ਸਾਡਾ ਆਹ ਕੰਮ ਵਿਗਾੜਿਆ ਵਾ ਇਹਨੇ ਕੀਤਾ ਜੋ ਕੀਤਾ ਵਾ ਹੋਰ ਨਹੀਂ ਕੋਈ ਕਰਨ ਵਾਲਾ ਜਿੱਥੇ ਜਿਵੇਂ ਕਹਿੰਦੇ ਆ ਵੀ ਉੱਡਦੇ ਫਿਰਨਾ ਬਹੁਤ ਖੁਸ਼ ਹੋਣਾ ਜਿਵੇਂ ਸਾਨੂੰ ਕੋਈ ਚੀਜ਼ ਲੱਭ ਗਈ ਹੈ ਅਤੇ ਅਸੀਂ ਉਹਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਾਂ ਵੀ ਅੱਜ ਲੱਗਦਾ ਕੁਝ ਲੱਭ ਗਿਆ ਵਾ ਬਹੁਤ ਉੱਡਦਾ ਫਿਰਦਾ ਵਾ ਕੋਈ ਚੀਜ਼ ਲੱਭੀ ਅੱਜ ਤੈਨੂੰ ਲੱਗਦਾ ਇੰਨਾ ਖੁਸ਼ ਤੁਰਦਾ ਫਿਰਦਾ ਵਾ ਜਾਂ ਉਬਾਲੇ ਮਾਰਨਾ ਜਿਵੇਂ ਗੁੱਸਾ ਆਉਣਾ ਸਾਨੂੰ ਤਾਂ ਅਸੀਂ ਕਹਿੰਦੇ ਵੀ ਅੱਜ ਉਬਾਲੇ ਮਾਰਦਾ ਫਿਰਦਾ ਵਾ ਕਿਹਦਾ ਗੁੱਸਾ ਕੱਢਣਾ ਵਾ ਵੀ ਰਾਣੋ ਨੇ ਆਪਣੇ ਗਵਾਂਢੀਆਂ ਨਾਲ ਮਾੜਾ ਚੰਗਾ ਬੋਲ ਬੋਲਿਆ ਅਤੇ ਮਨ ਦਾ ਸਾੜਾ ਉ ਗੁੱਸਾ ਕੱਢ ਲਿਆ ਇੰਨੇ ਉਬਾਲੇ ਮਾਰਦੀ ਫਿਰਦੀ ਅੱਜ ਇਹਨਾਂ ਨੂੰ ਕਹਿੰਦੇ ਆ ਕਿ ਜਿਵੇਂ ਆਪਾਂ ਰੋਜ਼ਾਨਾ ਜ਼ਿੰਦਗੀ 'ਚ ਗੱਲਬਾਤ 'ਚ ਬੋਲਦੇ ਮੁਹਾਵਰੇ ਇਹ ਉਹ ਹਨ